ਪੰਜਾਬ ਵਿੱਚ ਮੁੱਖ ਵਪਾਰਕ ਰੁਝਾਨ ਜਾਂ ਵਿਕਾਸ ਜੋ ਹਨ ਵਿਸ਼ਵੀਕਰਨ ਡਿਜੀਟਲਾਈਜੇਸ਼ਨ ਸਥਿਰਤਾ ਅਤੇ ਨਵੀਨਤਾ ਜੇ ਅਸੀਂ ਗੱਲ ਕਰਨਾ ਚਾਹੀਏ ਤਾਂ ਵਿਸ਼ਵੀਕਰਨ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਕਿਉਂਕਿ ਲੋਕਾਂ ਨੂੰ ਘੁੰਮਣਾ ਬਹੁਤ ਪਸੰਦ ਹੈ ਅਤੇ ਉਹ ਆਪਣੇ ਟਾਈਮ ਦੇ ਹਿਸਾਬ ਨਾਲ ਆਪਣੀ ਇੱਛਾ ਦੇ ਅਨੁਸਾਰ ਜਿਸ ਜਗ੍ਹਾ 'ਤੇ ਜਾਣਾ ਪਸੰਦ ਕਰਦੇ ਹਨ ਉਸ ਜਗ੍ਹਾ 'ਤੇ ਜਾਂਦੇ ਹਨ ਅਤੇ ਆਪਣੇ ਆਨੰਦ ਮਾਣਦੇ ਹਨ ਪੰਜਾਬ ਵਿੱਚ ਐਸੀਆਂ ਬਹੁਤ ਸਾਰੀਆਂ ਜਗਾਵਾਂ ਹਨ ਜਿੱਥੇ ਲੋਕ ਆਉਂਦੇ ਹਨ ਅਤੇ ਬਹੁਤ ਹੀ ਪ੍ਰਸਿੱਧ ਜਗਾਵਾਂ ਹਨ ਪੰਜਾਬ 'ਚ ਸਭ ਤੋਂ ਜ਼ਿਆਦਾ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਅਤੇ ਬਠਿੰਡਾ ਜ਼ਿਆਦਾ ਪ੍ਰਸਿੱਧ ਹਨ ਸਭ ਤੋਂ ਵਧੀਆ ਟਾਈਮ ਅਕਤੂਬਰ ਤੋਂ ਲੈ ਕੇ ਮਾਰਚ ਦੇ ਵਿੱਚ ਦਾ ਹੁੰਦਾ ਹੈ ਜਦੋਂ ਲੋਕ ਆਪਣਾ ਸਮਾਂ ਬਿਤਾਉਣ ਦੇ ਲਈ ਅਲੱਗ ਅਲੱਗ ਜਗ੍ਹਾ 'ਤੇ ਘੁੰਮਣ ਜਾਂਦੇ ਹਨ ਪੰਜਾਬ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਜਗਾਵਾਂ ਹਨ ਜੋ ਕਿ ਬਹੁਤ ਪ੍ਰਸਿੱਧ ਹਨ ਲੋਕਾਂ ਨੂੰ ਬਹੁਤ ਪਸੰਦ ਵੀ ਹਨ ਜਿਵੇਂ ਕਿ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਅਤੇ ਇਹ ਬਹੁਤ ਹੀ ਮੰਨਿਆ ਜਾਂਦਾ ਹੈ ਉਹ ਗੁਰਦੁਆਰਾ ਬਹੁਤ ਹੀ ਜ਼ਿਆਦਾ ਮਾਨ ਲਾਇਕ ਹੈ ਅਤੇ ਲੋਕਾਂ ਦੀ ਬਹੁਤ ਸ਼ਰਧਾ ਹੈ ਕਿ ਉਹ ਆਪਣਾ ਕੀਮਤੀ ਸਮਾਂ ਆਪਣਾ ਰੱਬ ਦੇ ਲਈ ਕੱਢਦੇ ਹਨ ਅਤੇ ਰਹਿਣ ਦੇ ਲਈ ਅੰਮ੍ਰਿਤਸਰ ਆਉਂਦੇ ਹਨ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਹਨ ਹੋਰ ਜ਼ਿਲ੍ਹਿਆਂ ਵਾਲਾ ਬਾਗ ਜੋ ਕਿ ਅੰਮ੍ਰਿਤਸਰ 'ਚ ਹੀ ਸਥਿਤ ਹੈ ਇਹ ਸਾਡੇ ਯਾਦ ਦੇ ਰੂਪ ਵਿੱਚ ਬਣਾਇਆ ਗਿਆ ਹੈ ਜਦੋਂ ਭਗਤ ਸਿੰਘ ਅਤੇ ਉਹਨਾਂ ਦੇ ਬਾਕੀ ਸਾਥੀ ਉੱਥੇ ਆਪਣੇ ਦੇਸ਼ ਦੇ ਲਈ ਲੜਾਈਆਂ ਲੜ ਰਹੇ ਸਨ ਉਹ ਸਮਾਂ ਕਿਸੇ ਨੂੰ ਨਹੀਂ ਭੁੱਲਦਾ ਜਦੋਂ ਇੱਥੇ ਗੋਲੀਆਂ ਚੱਲੀਆਂ ਸਨ ਵਿਸਾਖੀ ਦਾ ਉਹ ਸਮਾਂ ਜਦੋਂ ਲੋਕ ਆਪਣਾ ਪਿਆਰਾ ਜਿਹਾ ਸਮਾਂ ਕੱਢ ਕੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਵਿਸਾਖੀ ਦਾ ਆਨੰਦ ਲੈਣ ਲਈ ਆਏ ਸਨ ਇਸ ਤੋਂ ਇਲਾਵਾ ਹੋਰ ਵੀ ਕਈ ਜਗਾਵਾਂ ਹੈਗੀਆ ਜਿਵੇਂ ਕਿ ਚੰਡੀਗੜ੍ਹ ਵਿੱਚ ਸੁਖਨਾ ਲੇਕ ਚੰਡੀਗੜ੍ਹ ਦਾ ਰੋਕ ਗਾਰਡਨ ਇਹਨਾਂ ਜਗਾਵਾਂ ਵਿੱਚ ਲੋਕ ਆਪਣਾ ਅਲੱਗ ਅਲੱਗ ਜਗਾਵਾਂ 'ਤੇ ਜਾ ਕੇ ਆਨੰਦ ਲੈਂਦੇ ਹਨ ਆਪਣਾ ਸਮਾਂ ਬਿਤਾਉਂਦੇ ਹਨ ਅਤੇ ਆਪਣਾ ਮਨਪਸੰਦੀਦਾਰ ਚੀਜ਼ਾਂ ਲੈਂਦੇ ਹਨ ਇਸ ਤੋਂ ਇਲਾਵਾ ਵਾਹਗਾ ਬਾਰਡਰ ਵੀ ਬਹੁਤ ਪ੍ਰਸਿੱਧ ਹੈ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਹੈ ਲੋਕ ਆਉਂਦੇ ਹਨ ਜਦੋਂ ਪੰਦਰ੍ਹਾਂ ਅਗਸਤ ਅਤੇ ਛੱਬੀ ਜਨਵਰੀ ਨੂੰ ਇੱਥੇ ਬਾਰਡਰ 'ਤੇ ਬਹੁਤ ਹੀ ਮਹਿਫ਼ਿਲ ਲੱਗੀ ਹੁੰਦੀ ਹੈ ਸਾਡੇ ਦੇਸ਼ ਦੇ ਲਈ ਸਾਡੇ ਸੈਨਿਕ ਉੱਥੇ ਆਪਣਾ ਕਰਤੱਬ ਦਿਖਾਉਂਦੇ ਹਨ ਲੋਕਾਂ ਨੂੰ ਬਹੁਤ ਹੀ ਪਸੰਦ ਆਉਂਦਾ ਹੈ ਪੰਜਾਬ ਦੀ ਸਭ ਤੋਂ ਸੋਹਣੀ ਜਗ੍ਹਾ ਚੰਡੀਗੜ੍ਹ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਪੰਜਾਬ 'ਚ ਚੰਡੀਗੜ੍ਹ ਲੁਧਿਆਣਾ ਜਲੰਧਰ ਪਠਾਨਕੋਟ ਬਠਿੰਡਾ ਇਹਨਾਂ ਸਭ ਜਗਾਵਾਂ 'ਤੇ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਜਗਾਵਾਂ ਹਨ ਜੋ ਲੋਕਾਂ ਨੂੰ ਬਹੁਤ ਭਾਉਂਦੀਆਂ ਹਨ ਧੰਨਵਾਦ